ਸਾਡੇ ਇਲਾਕੇ 'ਚ ਆਵਾਜਾਈ ਦੇ ਬਾਰੇ ਗੱਲ ਕਰੀਏ ਤਾਂ ਸਾਡੇ ਜਿਹੜੇ ਤੇਈ ਨੰਬਰ ਰੋਡ ਆ ਉਹਦਾ ਬਹੁਤ ਬੁਰਾ ਹਾਲ ਆ ਖੱਡੇ ਨੇ ਬਹੁਤ ਜ਼ਿਆਦਾ ਮੀਂਹ ਦਾ ਪਾ ਬਾਰਿਸ਼ ਪੈਂਦੀ ਆ ਮੀਂਹ ਦਾ ਪਾਣੀ ਭਰ ਜਾਂਦਾ ਜਿਹੜੇ ਬੇਚਾਰੇ ਪੈਦਲ ਤੁਰ ਰਹੇ ਨੇ ਲੰਘਦੇ ਨੇ ਗੱਡੀਆਂ ਵਾਲੇ ਤੇਜ਼ ਸਪੀਡ ਨਾਲ ਕੱਢਦੇ ਨੇ ਕੱਪੜਿਆਂ 'ਤੇ ਦਾਗ ਪੈ ਜਾਂਦੇ ਛਿੱਟੇ ਪੈ ਜਾਂਦੇ ਨੇ ਉਹ ਤੋਂ ਇਲਾਵਾ ਵੀ ਖੱਡਿਆਂ ਕਰਕੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਰਾਤ ਦੇ ਵੇਲੇ ਕੋਈ ਲੈਟਾਂ ਦਾ ਪ੍ਰਬੰਧ ਨਹੀਂ ਹੈਗਾ ਜਿਵੇਂ ਹੁਣ ਧੁੰਦਾਂ ਵੱਧ ਰਹੀਆਂ ਨੇ ਅੱਗੇ ਅੱਗੇ ਜਿਸ ਨਾਲ ਐਕਸੀਡੈਂਟ ਹੋਣ ਦਾ ਕਾਰਨ ਬਹੁਤ ਜ਼ਿਆਦਾ ਵਧੀ ਜਾ ਰਿਹਾ ਹੋ ਵੀ ਰਹੇ ਨੇ ਐਕਸੀਡੈਂਟ ਅਤੇ ਹੁਣ ਗੱਲ ਕਰੀਏ ਆਪਾਂ ਬੱਸਾਂ 'ਚ ਭੀੜ ਦੀ ਤਾਂ ਸਾਡੇ ਯੂਨੀਵਰਸਿਟੀ ਰੋਡ ਆ ਜਿਹੜਾ ਉੱਥੇ ਬਹੁਤ ਜ਼ਿਆਦਾ ਬੱਸਾਂ ਦੀ ਭੀੜ ਹੁੰਦੀ ਹੈ ਕੁਛ ਤਾਂ ਬੱਚੇ ਪੜ੍ਹਦੇ ਨੇ ਯੂਨੀਵਰਸਿਟੀ ਅਤੇ ਊਂ ਵੀ ਬੱਸ ਸਟੈਂਡ ਲੱਗ ਜਾਂਦਾ ਲਾਗੇ ਉਹਦੇ ਕਰਕੇ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਧੱਕਾ ਮੁੱਕੀ ਹੁੰਦਾ ਬੈਠਣ ਤੱਕ ਦੀਆਂ ਜਗ੍ਹਾਵਾਂ ਨਹੀਂ ਮਿਲਦੀਆਂ ਅਤੇ ਦਿੱਲੀ ਰੇਲਗੱਡੀ ਦੇ ਪਾਸੇ ਆਪਾਂ ਗੱਲ ਕਰੀਏ ਤਾਂ ਜਿਹੜੀ ਦਿੱਲੀ ਰਾਜਪੁਰਾ ਅੰਬਾਲਾ ਨੂੰ ਜਾਂਦੇ ਰੇਲ ਗੱਡੀ ਉਹਨਾਂ 'ਚ ਬਹੁਤ ਜ਼ਿਆਦਾ ਭੀੜ ਹੁੰਦੀ ਆ ਕਰਨੇ ਵੀ ਇੱਕ ਹੀ ਉੱਧਰ ਜਿਹੜੇ ਵਪਾਰੀ ਨੇ ਵਪਾਰ ਕਰਨ ਵੀ ਆਉਂਦੇ ਨੇ ਬ ਉੱਥੋਂ ਦਿੱਲੀ ਤੋਂ ਸਮਾਨ ਸਸਤਾ ਮਿਲਦਾ ਲੋਕ ਉੱਧਰੋਂ ਸਮਾਨ ਵੀ ਲੈ ਕੇ ਆਉਂਦੇ ਇਸ ਕਰਕੇ ਉਹਨਾਂ 'ਚ ਭੀੜ ਵੀ ਬਹੁਤ ਜ਼ਿਆਦਾ ਹੁੰਦੀ ਆ ਅਤੇ ਜਿਹੜੀ ਹੁਣ ਆਪਾਂ ਰੇਲ ਗੱਡੀ ਸਫਰ ਦੀ ਗੱਲ ਕਰੀਏ ਸਫਰ 'ਚ ਜਿਹੜੀ ਮੁਸ਼ਕਲਾਂ ਆੳਂਦੀਆਂ ਨੇ ਉਸ ਤਰ੍ਹਾਂ ਨਹੀਂ ਵੀ ਕੋਈ ਬੰਦਾ ਹੁਣ ਦੁਮਰਪਾਨ ਦਾ ਸੇਵਨ ਕਰਦਾ ਕੋਈ ਨਹੀਂ ਕਰਦਾ ਅਤੇ ਆਪਾਂ ਜਾ ਰਹੇ ਹੁੰਦੇ ਕਿਤੇ ਅਤੇ ਨਾਲ ਦਾ ਬੈਠਾ ਬੰਦਾ ਅਗਲਾ ਸਿਗਰਟਾਂ ਪੀ ਜਾਂਦਾ ਜੇ ਉਹਨੂੰ ਕਹੋ ਤਾਂ ਅਗਲਾ ਗਲ ਪੈਣ ਨੂੰ ਬੰਦਾ ਹਟਦਾ ਵੀ ਨਹੀਂ ਉਸ ਤੋਂ ਇਲਾਵਾ ਵੀ ਜਿਹੜੇ ਹੋਰ ਬੰਦੇ ਆਈ ਜਾਂਦੇ ਨੇ ਤੰਗ ਕਰੀ ਜਾਂਦੇ ਨੇ ਧੱਕੇਸ਼ਾਹੀ ਨਾਲ ਕੱਪੜੇ ਤੱਕ ਖਿੱਚਣ ਨੂੰ ਜਾਂਦੇ ਨੇ ਅਤੇ ਲੇਡੀਜ਼ ਹੁੰਦੀਆਂ ਬੇਚਾਰੀਆਂ ਕੋਈ ਕਿਸੇ ਇਲਾਕੇ ਦੀ ਹੈ ਕੋਈ ਕਿਸੇ ਦੀ ਹੈ ਕੋਈ ਸਾਊ ਹੈ ਕੋਈ ਕਿਵੇਂ ਉਨ੍ਹਾਂ ਹਰਾਸਮੈਂਟ ਹੁੰਦੇ ਆ ਤੰਗ ਕਰਦੇ ਨੇ ਲੋਕ ਨਸ਼ਾ ਕਰਕੇ ਹੋਸ਼ 'ਚ ਨਹੀਂ ਹੁੰਦੇ ਇਸ ਚੀਜ਼ਾਂ ਮਾ ਥੋੜ੍ਹਾ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਅਤੇ ਇਹੀ ਬੇਨਤੀ ਆ